ਹੈਲੋ ਹੈਲੋ ਹਾਂਜੀ ਹਾਂਜੀ

ਤੁਹਾਨੂੰ ਟੈਂਟ ਦਾ ਕੈਟਰਿੰਗ ਦਾ ਅਤੇ ਡੈਕੋਰੇਸ਼ਨ ਦਾ ਇਹਦਾ ਪ੍ਰਬੰਧ ਕਰਦੇ ਹਾਂ ਜੀ ਅਸੀਂ ਨਹੀਂ ਇਹ ਜਿਹੜੀ ਡੈਕੋਰੇਸ਼ਨ ਆ ਇਹਦਾ ਐਕਸਟਰਾ ਚਾਰਜ ਲੱਗੇਗਾ ਉਹ ਸਟੋਲ ਅਲੱਗ ਅਲੱਗ ਲੱਗਣਗੇ ਹਰੇਕ ਸਟੋਲ ਦਾ ਰੇਟ ਅਲੱਗ ਅਲੱਗ ਲੱਗੇਗਾ ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਵੀ ਕਿੰਨੀਆਂ ਸਟੋਲਾਂ ਲਗਾਓਂਗੇ ਤੁਸੀਂ ਅਸੀਂ ਸਟੋਲ ਲਗਾ ਦਾਂਗੇ ਜੋ ਤੁਸੀਂ ਕਹੋਗੇ ਉਹ ਸਟੋਲ ਅਸੀਂ ਲਗਾਦ ਲਗਾ ਦਾਂਗੇ ਉਹਦਾ ਰੇਟ ਫਿਰ ਵੱਖਰਾ ਹੋਏਗਾ ਅਲੱਗ ਪ੍ਰਾਈਜ਼ ਉਹ ਉਹ ਵਿੱਚ ਹੀ ਹੋਏਗਾ ਹਾਂ ਉਹ ਵਿੱਚ ਹੋਏਗਾ ਹਾਂ ਇਹ ਅਸੀਂ ਉੱਥੇ ਇੱਕ ਤਾਂ ਜਗ੍ਹਾ ਦੇਖਣੀ ਪਏਗੀ ਵੀ ਕਿੰਨਾਂ ਤੁਹਾਡਾ ਟੈਂਟ ਲੱਗਣਾ ਹੈ ਜਾਂ ਅਤੇ ਉਹ ਤੋਂ ਇਹ ਤੋਂ ਬਾਅਦ

ਠੀਕ ਹੈ ਓਕੇ ਥੈਂਕ ਯੂ ਥੈਂਕ ਯੂ